ਹੈਲੋ ਹਾਂਜੀ ਮੇਰਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨੀਰੂ ਹੈ ਔਰ ਮੈਂ ਅੱਜ ਜਾਨਵਰ ਦੇ ਬਾਰੇ ਮਤਲਬ ਕਿ ਗੱਲ ਕਰਨਾ ਚਾਹੁੰਦੇ ਹਾਂ ਕਿ ਅੱਛੀ ਨਸਲ ਦੀ ਪਹਿਚਾਣ ਅਸੀਂ ਕਿਵੇਂ ਕਰ ਸਕਦੇ ਹਾਂ ਜਦੋਂ ਅਸੀਂ ਕੋਈ ਵੀ ਜਾਨਵਰ ਲੈਣ ਜਾਂਦੇ ਹਾਂ ਉਹ ਤੋਂ ਪਹਿਲਾਂ ਉਹਨਾਂ ਤੋਂ ਮਤਲਬ ਅੱਛੀ ਉਹਨਾਂ ਦੀ ਥੋੜ੍ਹੀ ਅਸੀਂ ਜਾਣਕਾਰੀ ਲਵਾਂਗੇ ਵੀ ਇਹ ਮਤਲਬ ਕਿ ਜਾ ਮਤਲਬ ਕਿ ਜਾਨਵਰ ਜਿਸ ਤੁਸੀਂ ਇੱਕ ਗਾਂਈ ਹੀ ਦੇ ਮਤਲਬ ਅਸੀਂ ਲੈਣ ਜਾਵਾਂਗੇ ਜਾ ਮੱਝ ਲੈਣ ਜਾਵਾਂਗੇ ਜਿਵੇਂ ਅਸੀਂ ਘਰ ਆਪਣੇ ਰੱਖੀ ਵੀ ਹੋਈ ਸੀ ਔਰ ਮ ਮਤਲਬ ਕਿ ਸਾਰਿਆਂ ਨਾਲੋਂ ਪਹਿਲਾਂ ਮਤਲਬ ਕਿ ਅਸੀਂ ਉਹਦੀ ਇਹ ਦੇਖਾਂਗੇ ਮਤਲਬ ਕਿ ਇਹ ਜਾਨਵਰ ਮਤਲਬ ਪਸ਼ੂ ਸਾਨੂੰ ਕਿੰਨਾ ਦੁੱਧ ਦੇ ਸਕਦਾ ਹੈ ਔਰ ਅੱਛੀ ਨਸਲ ਦਾ ਹੈ ਕਿ ਨਹੀਂ ਉਹਦੇ ਬਾਅਦ ਜੋ ਵੀ ਮਤਲਬ ਕਿ ਅਸੀਂ ਲੱਛਣ ਉਹਨਾਂ ਦੇ ਹੁੰਦੇ ਕਿ ਉਹ ਮਤਲਬ ਕਿ ਵੱਧ ਤੋਂ ਵੱਧ ਮਤਲਬ ਕਿ ਸਾਨੂੰ ਉਹ ਦੁੱਧ ਅਤੇ ਔਰ ਇਹ ਹੀ ਮਤਲਬ ਕਿ ਅੱਛੀ ਸਿਹਤਮੰਦ ਵਾਲੀ ਹੋਵੇ ਔਰ ਅੱਛਾ ਘਾਹ ਮਤਲਬ ਜੋ ਵੀ ਅਸੀਂ ਉਹਨੂੰ ਪਾਉਂਦੇ ਹਾਂ ਉਹ ਅੱਛੇ ਤਰੀਕੇ ਦਾ ਹੋ ਹੋਣਾ ਬਹੁਤ ਜ਼ਰੂਰੀ ਹੈ ਜਿਸ ਕਰਕੇ ਮਤਲਬ ਕਿ ਅਸੀਂ ਉਹਨੂੰ ਕੋਈ ਵੀ ਉਹਨੂੰ ਜੇ ਤੁਹਾਨੂੰ ਕੋਈ ਪ੍ਰੋਬਲਮ ਆਵੇ ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਇਹ ਹੀ ਕਰੀ ਬਈ ਉਹਨੂੰ ਇਹ ਅੱਛਾ ਮਤਲਬ ਕਿ ਖਾ ਦੇ ਸਕੀਏ ਉਹਨੂੰ ਖਾਦ ਦੇ ਸਕੀਏ ਅਤੇ ਜਿਸ ਕਰਕੇ ਉਹ ਸਾਨੂੰ ਕਿ ਉਹ ਦੁੱਧ ਮਤਲਬ ਕਿ ਬਹੁਤ ਹੀ ਵਧੀਆ ਮਤਲਬ ਕਿ ਸਾਨੂੰ ਦੋ ਟਾਈਮ ਮਤਲਬ ਕਿ ਅੱਛਾ ਤਰ੍ਹਾਂ ਮਤਲਬ ਅੱਛੀ ਤਰ੍ਹਾਂ ਸਾਨੂੰ ਉਹ ਦੁੱਧ ਦੇ ਸਕੇ ਔਰ ਅਗਰ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੋਵੇ ਤਾਂ ਅਸੀਂ ਮਤਲਬ ਡੰਗਰ ਡਾਕਟਰ ਜੋ ਹੁੰਦੇ ਆ ਅਸੀਂ ਉਹਨਾਂ ਤੋਂ ਸਲਾਹ ਲੈ ਸਕਦੇ ਹਾਂ ਕਿ ਜੋ ਵੀ ਹੋਵੇ ਮਤਲਬ ਕਿ ਸਾਨੂੰ ਉਹ ਆਪਣੀ ਸਲਾਹ ਦੇਣ ਔਰ ਉਹ ਪੂਰੀ ਅਸੀਂ ਉਹਨਾਂ ਦੀ ਫਿਰ ਟਰੀਟਮੈਂਟ ਅਸੀਂ ਕਰ ਸਕਦੇ ਹਾਂ ਮਤਲਬ ਪੂਰੀ ਤਰ੍ਹਾਂ ਮਤਲਬ ਕਿ ਅਸੀਂ ਉਹਨੂੰ ਪੁੱਛ ਕੇ ਅੱਛੀ ਮਤਲਬ ਕਿ ਉਹਦੀ ਇਹ ਟਰੀਟਮੈਂਟ ਕਰਵਾ ਸਕਦੇ ਹਾਂ ਥੈਂਕ ਯੂ ਜੀ